ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਹਾਂਜੀ

ਹਾਂਜੀ ਮੈਮ

ਹਾਂਜੀ ਮੈਮ ਹਾਂਜੀ ਮੈਮ ਇੱਥੇ ਗੋਲਡਨ ਟੈਂਪਲ ਵਿੱਚ ਲੰਗਰ ਦਾ ਪ੍ਰਬੰਧ ਸੱਤ ਵਜੇ ਤੋਂ ਲੈ ਕੇ ਰਾਤ ਦੇ ਦਸ ਵਜੇ ਤੱਕ ਖੁਲ੍ਹਾ ਲੰਗਰ ਚੱਲਦਾ ਰਹਿੰਦਾ ਹੈ ਇੱਥੇ ਤੁਸੀਂ ਸੇਵਾ ਆਪਣੀ ਮਰਜ਼ੀ ਨਾਲ ਕਿਸੇ ਵੀ ਟਾਈਮ ਕਰ ਸਕਦੇ ਹੋ ਬਸ ਤੁਹਾਨੂੰ ਇਸ ਚੀਜ਼ਾਂ ਦਾ ਧਿਆਨ ਰੱਖਣਾ ਪਊਗਾ ਕਿ ਤੁਸੀਂ ਆਪਣੀ ਪਹਿਰਾਵਾ ਵਧੀਆ ਪਾਇਆ ਹੋਵੇ ਅਤੇ ਸਿਰ ਪੂਰਾ ਢੱਕਿਆ ਹੋਵੇ ਅਤੇ ਤੁਸੀਂ ਸੇਵਾ ਕਿਸੇ ਵੀ ਟਾਈਮ ਆ ਕੇ ਉੱਥੇ ਕਰ ਸਕਦੇ ਹੋ ਇੱਕ ਘੰਟਾ ਦੋ ਘੰਟੇ ਜਿੰਨਾ ਚਿਰ ਤੁਸੀਂ ਕਰਨਾ ਚਾਹੋ ਆਪਣੀ ਇੱਛਾ ਅਨੁਸਾਰ ਹਾਂਜੀ ਮੈਮ ਇੱਕ ਤਾਂ ਆਪਾਂ ਲੰਗਰ ਆਪਦੇ ਆਪਣਾ ਗੁਰਦੁਆਰਾ ਸਾਹਿਬ 'ਚ ਜੋ ਖਾਂਦੇ ਹਾਂ ਹੈ ਨਾ ਪ੍ਰਸ਼ਾਦਾ ਖਾਂਦੇ ਹਾਂ ਉਹਦਾ ਆਪਣੀ ਆਮ ਖਾਣ ਪੀਣ ਵਾਲੀਆਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਬੈਟਰ ਵਧੀਆ ਹੁੰਦਾ ਆ ਇੱਥੇ ਹਰ ਇਕ ਚੀਜ਼ ਨੂੰ ਬੜੀ ਜਾਂਚ ਨਾਲ ਬਣਾਇਆ ਜਾਂਦਾ ਆ ਵਾਹਿਗੁਰੂ ਦਾ ਨਾਮ ਲੇ ਕੇ ਲੈ ਕੇ ਫਿਰ ਇਹਨੂੰ ਖਾਣ ਵਿੱਚ ਵੀ ਬਹੁਤ ਆਨੰਦ ਮਿਲਦਾ ਆ ਅਤੇ ਸੇਵਾ ਨਾਲ ਵੀ ਆਪਾਂ ਨੂੰ ਸੰਤੁਸ਼ਟੀ ਮਿਲਦੀ ਆ ਆਰਾਮ ਮਿਲਦਾ ਸਕੂਨ ਮਿਲਦਾ ਆ ਅਤੇ ਹਾਂਜੀ ਮੈਮ ਹਾਂਜੀ ਇਹ ਸਭ ਕੁਛ ਹਾਂਜੀ

ਹਾਂਜੀ ਵੈਲਕਮ